ਭਾਰਤ ਸਰਕਾਰ ਨੇ ਬਹੁਤ ਸਕੀਮਾਂ ਭਾਰਤ ਦੇ ਵਿੱਚ ਸ਼ੁਰੂ ਕੀਤੀਆਂ ਹਨ ਜਿਹੜੀ ਸਕੀਮ ਵਿੱਚ ਮੈਂ ਦਾਖਲ ਹੋਇਆ ਹਾਂ ਉਸ ਸਕੀਮ ਦਾ ਨਾਂ ਹੈ ਸਿਹਤ ਬੀਮਾ ਯੋਜਨਾ ਅਤੇ ਸਿਹਤ ਬੀਮਾ ਯੋਜਨਾ ਦੇ ਵਿੱਚ ਸਾਨੂੰ ਪੰਜ ਲੱਖ ਤੱਕ ਦਾ ਇਲਾਜ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਮੁਫ਼ਤ ਮਿਲ ਸਕਦਾ ਹੈ ਅਤੇ ਸਾਨੂੰ ਆਰਥਿਕ ਪੱਖੋਂ ਸਹਾਇਤਾ ਮਿਲ ਜਾਂਦੀ ਹੈ